ਹੈਲੋ ਹਾਂਜੀ ਕੀ ਹਾਲ ਨੇ ਜੀ ਪਛਾਣਿਆ ਮੈਨੂੰ ਮੈਂ ਬੋਲ ਰਿਹਾਂ ਜੀ ਗੁਰੂ ਰੰਧਾਵਾ ਹਾਂਜੀ ਹਾਂਜੀ ਹਾਂਜੀ ਹਾਂਜੀ ਗਾਣੇ ਗਾਉਣ ਵਾਲਾ ਜੀ ਗਾਣੇ ਗਾਉਣ ਵਾਲਾ ਤੁਸੀਂ ਵੱਡੇ ਬੰਦੇ ਹੋ ਸਾਨੂੰ ਕਿੱਥੇ ਪਛਾਣੋਗੇ ਜੀ

ਅੱਛਾ ਜੀ ਅੱਛਾ ਫਿਰ ਹੁਣ ਤੁਸੀਂ ਵੱਡੇ ਬੰਦੇ ਹੋ ਸਾਡੇ ਵਰਗਿਆਂ ਦੇ ਗਾਣੇ ਕਿੱਥੇ ਸੁਣਨੇ ਤੁਸੀਂ ਹਾਂਜੀ ਜੀ ਨਹੀਂ ਹਾਂਜੀ ਓ ਚਲੋ ਕੋਈ ਨਹੀਂ ਕੁੜੀਆਂ ਤਾਂ ਸੁਣਦੀਆਂ ਨੇ ਸਾਨੂੰ ਜੇ ਮੁੰਡੇ ਨਹੀਂ ਸੁਣਦੇ ਚਲੋ ਫਿਰ ਕੀ ਹੋ ਗਿਆ ਜੀ ਉਹ ਮੈਂ ਪੁੱਛਣਾ ਸੀਗਾ ਜੀ ਮੈਂ ਪੁੱਛਣਾ ਸੀ ਕੋਈ ਮੇਰੇ ਲਾਇਕ ਰੋਲ ਹੋਵੇ ਜੀ ਤੁਹਾਡੇ ਕੋਲ ਹਾਂਜੀ ਹਾਂਜੀ ਹਾਂਜੀ ਫਿਲਮ ਗਾਣੇ ਦੋਵਾਂ 'ਚ ਚੱਲੂਗਾ ਜੀ

ਕਿਹੜੀ ਫਿਲਮ ਆਈ ਅੱਛਿਆ ਜੀ ਜਿਊਣਾ ਮੋੜ ਜੀਪ 'ਤੇ ਫਰਾਰ ਹੋ ਗਿਆ ਵੀ ਕਿਸ ਟਾਈਪ ਦਾ ਰੋਲ ਹੈ ਜੀ ਮੇਰੇ ਕੋਲ ਅੱਛਾ ਜੀ ਨਹੀਂ ਕੋਈ ਹੋਰ ਰੋਲ ਹੋਵੇ ਜੀ ਮੇਰੇ ਲਾਇਕ ਬੰਦੂਕ ਬਦਾਕ ਵਾਲਾ ਤਾਂ ਹੈ ਨਹੀਂ ਮੈਨੂੰ ਪਸੰਦ ਨਹੀਂ ਹੀਰੋ ਦਾ ਚਲੋ ਹੀਰੋ ਆਲਾ ਉਹਦਾ ਕੀ ਰੋਲ ਹੈ ਜੀ ਜਿੰਮ ਵੀ ਲਾ ਲਵਾਂਗੇ ਬਣਾ ਲਵਾਂਗੇ ਸਰੀਰ ਵੀ ਨਹੀਂ ਨਹੀਂ ਕੋਈ ਨਹੀਂ ਵਧਾ ਲਵਾਂਗੇ ਸਰੀਰ ਵਧਾ ਲਵਾਂਗੇ ਖਾ ਪੀ ਕੇ ਕੋਈ ਨਹੀਂ ਜੀ ਮਤਲਬ ਹੀਰੋ ਦਾ ਕਿਸ ਟਾਈਪ ਦਾ ਰੋਲ ਹੈ ਜੀ ਅੱਛਿਆ ਜੀ ਕੁੱਟ ਮਾਰ ਵਾਲਾ ਚਲੋ ਕੁੱਟ ਮਾਰ ਕਿਵੇਂ ਮਤਲਬ ਗੁੰਡਾ ਟਾਈਪ ਜੀ ਅੱਛਿਆ ਜੀ ਗੁੰਡਾ ਟਾਈਪ 'ਚ ਹੋਰ ਕੋਈ ਐਕਟਰੈਸ ਕਿਹੜੀ ਲਈ ਹੈ ਜੀ ਸੋਨਮ ਬਾਜਵਾ ਚਲੋ ਵਧੀਆ ਗੱਲ ਆ ਜੀ ਮੇਰੀ ਫੀਸ ਫੂਸ ਦਾ ਕੀ ਹਿਸਾਬ ਕਿਤਾਬ ਆ ਜੀ ਅੱਛਾ ਜੀ ਹਾਂਜੀ ਚਲੋ ਚਲੋ ਐਕਟਰੈਸ ਤਾਂ ਸਹੀ ਹੈ ਜੀ ਪਰ ਮੈਨੂੰ ਰੋਲ ਥੋੜ੍ਹਾ ਜਿਹਾ ਵਧੀਆ ਦਵਾ ਦਿੰਦੇ ਵਧੀਆ ਕੋਈ ਜਿਵੇਂ ਕਿ ਕਿਸੇ ਦੀ ਹੈਲਪ ਕਰਨਾ ਕੋਈ ਇਹ ਜਿਹਾ ਰੋਲ ਦਵਾ ਦਿੰਦੇ ਚਾਹੇ ਹੀਰੋ ਦਾ ਨਾ ਹੀ ਹੋਵੇ ਕੀਹਦੇ ਨਾਲ ਜੀ ਹੀਰੋ ਦੇ ਨਾਲ ਅੱਛਿਆ ਜੀ ਜੀ ਕਮਤਲਬ ਕਿਸੇ ਦੇ ਕਿਸੇ ਨੇ ਕੁੱਟਮਾਰ ਹੋ ਗਈ ਉਹਦੀ ਦਵਾਈ ਬੂਟੀ ਵਗੈਰਾ ਚੁੱਕ ਕੇ ਲੈ ਜਾਣ ਵਾਲਾ ਕੰਮ ਅੱਛਾ ਜੀ ਚਲੋ ਕੋਈ ਨੀ ਇਹ ਜਾ ਕੋਈ ਵਧੀਆ ਇਮੋਸ਼ਨ ਵਧੀਆ ਜਿਹਾ ਰੋਲ ਦਿਵਾਇਓ ਵੀ ਜਿਹੜਾ ਕਿਸੇ ਨੂੰ ਮੈਸੇਜ ਵੀ ਜਾਵੇ ਆਪਣਾ ਕੋਈ ਗਲਤ ਰੋਲ ਨਾ ਹੋਇਆ ਹੋਵੇ ਚਲੋ ਵਧੀਆ ਗੱਲ ਹੈ ਜੀ ਵੱਡੇ ਬੰਦੇ ਵੀ ਸਾਡੇ ਤੋਂ ਮੋਹਿਤ ਹੋਏ ਓ ਨਹੀਂ ਉਹ ਕਹਿੰਦੇ ਨਹੀਂ ਹੁੰਦੇ ਵੀ ਲੁੱਕ ਤੋਂ ਕਦੇ ਵੀ ਕਿਸੇ ਬੰਦੇ ਨੂੰ ਜੱਜ ਨਹੀਂ ਕਰਨਾ ਚਾਹੀਦਾ ਹਾਂਜੀ ਹਾਂਜੀ ਉਹੀ ਤਾਂ ਗੱਲ ਹੈ ਜੀ ਆਪਾਂ ਥੋੜ੍ਹੀ ਇਹ ਜਿਹੀ ਫਿਲਮ ਕਰੀਏ ਵੀ ਲੋਕਾਂ ਨੂੰ ਮੈਸੇਜ ਵੀ ਜਾਵੇ ਕੋਈ ਗਲਤ ਇਨਫੋਰਮੇਸ਼ਨ ਨਾ ਜਾਵੇ ਚਲੋ ਤੁਸੀਂ ਹੁਣ ਕਿੱਥੇ ਹੋ ਇਸ ਟਾਈਮ ਚਲੋ ਕੋਈ ਨਹੀਂ ਫਿਰ ਮਿਲਦੇ ਆ ਆਪਾਂ ਤਿੰਨ ਮਹੀਨੇ ਬਾਅਦ ਜੀ ਹੁਣ ਮਤਲਬ ਮੇਰਾ ਰੋਲ ਪੱਕਾ ਜੀ ਚਲੋ ਠੀਕ ਹੈ ਜੀ ਫਿਰ ਮਿਲਦੇ ਆ ਓਕੇ ਮੈਂ ਇਸ ਟਾਈਮ ਜੀ ਪਿੰਡ ਬੈਠਾ ਆਪਣੇ ਮੇਰਾ ਜੀ ਇਧਰ ਆਪਣੇ ਮੁੱਲਾਂਪੁਰ ਦਾਖਾ ਕਨੀ ਹੈ ਜੀ ਹਾਂਜੀ ਹਾਂਜੀ ਅੱਛਾ ਜੀ ਅੱਛਾ ਤਸੀਂ ਉੱਥੇ ਰਹਿੰਦੇ ਹੋ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਚਲੋ ਠੀਕ ਜੀ ਠੀਕ ਆ ਜੀ ਆ ਜਾਵਾਂਗੇ ਹਾਂਜੀ ਹਾਂਜੀ ਵਿਹਲੇ ਆ ਜੀ ਮੈਂ ਤਾ ਵਿਹਲਾ ਹੀ ਹੁੰਦਾ ਤਾ ਹੀ ਪੁੱਛਿਆ ਤੁਹਾਨੂੰ ਚਲੋ ਠੀਕ ਹੈ ਜੀ ਫਿਰ ਮਿਲਦੇ ਆ ਆਪਾਂ ਓਕੇ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਓਕੇ ਜੀ